ਹਾਂਜੀ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਲੋਕਡਾਊਨ ਵਿੱਚ ਮੋਬਾਇਲ ਲੈਪਟੋਪ ਦੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਆਨਲਾਈਨ ਸਕੂਲਿੰਗ ਜਾਂ ਘਰ ਤੋਂ ਕੰਮ ਕਰਨ ਦਾ ਮੇਰਾ ਤਜਰਬਾ ਵਧੀਆ ਸੀ ਕਿਉਂਕਿ ਇਸ ਨਾਲ ਸਾਨੂੰ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਆਨਲਾਈਨ ਸਕੂਲਿੰਗ ਦੇ ਕਈ ਲਾਭ ਦੇ ਨਾਲ ਨਾਲ ਇਸਦੇ ਕਾਫੀ ਨੁਕਸਾਨ ਵੀ ਹਨ ਕਈ ਬੱਚੇ ਆਨਲਾਈਨ ਸਕੂਲਿੰਗ ਕਹਿ ਕੇ ਸਾਰਾ ਸਮਾਂ ਫੋਨ ਵਿੱਚ ਲੱਗੇ ਰਹਿੰਦੇ ਸੀ